ਇਹਨਾਂ ਪੌਦਿਆਂ ਦੀ ਜਿਹੜੀ ਅਸੀਂ ਦੇਖਭਾਲ ਕਰਦੇ ਹਾਂ ਉਹ ਖੁਰਪੀ ਦੇ ਨਾਲ ਕਰਦੇ ਹੈ ਖੁਰਪੀ ਦੇ ਨਾਲ ਟੋਆ ਬਣਾਉਂਦੇ ਹਾਂ ਫਿਰ ਅਸੀਂ ਵਿੱਚ ਪੌਦੇ ਨੂੰ ਲਾ ਕੇ ਡੂੰਘਾ ਟੋਆ ਬਣਾ ਕੇ ਅਤੇ ਪੌਦਾ ਵਿੱਚ ਰੱਖ ਕੇ ਫਿਰ ਉਹਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਜੋ ਉਹ ਉਦੋਂ ਬਾਅਦ ਅਸੀਂ ਖੁਰਪੀ ਦੀ ਫਿਰ ਵਰਤੋਂ ਕਰਦੇ ਹਾਂ ਗੋਡੀ ਪਾਉਣ ਲਈ ਦੋ ਚਾਰ ਦਿਨਾਂ ਤੱਕ ਵੀ ਗੋਡੀ ਪਾਉਣੀ ਪੈਂਦੀ ਹੈ ਅਤੇ ਉਹਦੀ ਜੜ੍ਹ ਪੋਲੀ ਕਰਕੇ ਸਾਨੂੰ ਪਾਣੀ ਦੇਣਾ ਪੈਂਦਾ ਜੋ ਖਾਦ ਦੇਣੀ ਪੈਂਦੀ ਹੈ ਡੀ ਪੀ ਪਾਉਣੀ ਪੈਂਦੀ ਹੈ ਅਤੇ ਜਦੋਂ ਉਹ ਬੂਝੇ ਵੱਡੇ ਹੋ ਜਾਂਦੇ ਆ ਤਾਂ ਉਹਨਾਂ ਦੇ ਮੁੱਢਾਂ ਨੂੰ ਕਲੀ ਵੀ ਕਰਨੀ ਪੈਂਦੀ ਹੈ ਫਿ ਫਿਰ ਇਹ ਬੂਝਿਆਂ ਨੂੰ ਹੌਲੀ ਹੌਲੀ ਚੱਲਦੇ ਨੇ ਗੇ ਪਾਣੀ ਪੂਣੀ ਦਿੰਦੇ ਹਾਂ ਖਾਦਾਂ ਪਾਉਣੇ ਹੈ ਗੋਡੀਆਂ ਪਾਉਣੇ ਹੈ ਗੋਡੀ ਪਾ ਕੇ ਅਤੇ ਫਿਰ ਇਹ ਬੂਝਿਆਂ ਦੀ ਹੌਲੀ ਹੌਲੀ ਸੰਭਾਲ ਕਰਕੇ ਅਤੇ ਫਿਰ ਬੂਝੇ ਫ਼ਲਾਂ ਦੇ ਉੱਤੇ ਆਉਂਦੇ ਨੇ ਅਤੇ ਫ ਫਿਰ ਫ਼ਲ ਦਿੱਤੇ ਜਾਂਦੇ ਆ ਅਤੇ ਜਦੋਂ ਉਹ ਬੂਝੇ ਫ਼ਲਾਂ 'ਤੇ ਆ ਜਾਂਦੇ ਤਾਂ ਉਦੋਂ ਉਹਨਾਂ ਦੀ ਸਿਹਤ ਸੰਭਾਲ ਹੈ ਜਿਹੜੀ ਉਹ ਦੁੱਗਣੀ ਵੱਧ ਜਾਂਦੀ ਹੈ ਬਚਪਨ ਨਾਲੋਂ ਦੁੱਗਣੀ ਵੱਧ ਜਾਂਦੀ ਹੈ ਉਹਨਾਂ ਦੀ ਖੁਰਾਕ ਵੀ ਅਤੇ ਸਿਹਤ ਸੰਭਾਲ ਵੀ ਅਤੇ ਗਰਮੀ 'ਚ ਵੀ ਇਹ ਥੋੜ੍ਹੀ ਜਿਹੀ ਛਾਂ ਜੂਨ ਦੇ ਮਹੀਨੇ ਦੇ ਵਿੱਚ ਭਾਲਦੇ ਹਨ ਪੌਦੇ ਮੱਚਣ ਤੋਂ ਬਹੁਤਾ ਇਹਨਾਂ ਦਾ ਦਾ ਵੀ ਡਰ ਰਹਿੰਦਾ ਅਤੇ ਸਰਦੀ ਦੇ ਵਿੱਚ ਤਾਂ ਕੋਈ ਗੱਲ ਨਹੀਂ ਹਜੇ ਚੱਲੀ ਜਾਂਦਾ ਅਤੇ ਗਰਮੀ ਵਿੱਚ ਵੀ ਥੋੜ੍ਹੇ ਜਿਹੇ ਇਹ ਬੂਝੇ ਵੀ ਬਚਾ ਕੇ ਰੱਖਣੇ ਪੈਂਦੇ ਹੈ